ਪੰਜਾਬੀ ਸੱਭਿਆਚਾਰਕ ਦੇ ਵਿੱਚ ਭੰਗੜੇ ਦੀ ਬਹੁਤ ਹੀ ਜ਼ਿਆਦੀ ਮਹੱਤਤਾ ਹੈ ਕਿਉਂਕਿ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਔਰ ਪੰਜਾਬੀਅਤ ਹੈ ਔਰ ਸਕੂਲਾਂ ਵਿੱਚ ਕਾਲਜਾਂ ਵਿੱਚ ਭੰਗੜੇ ਦਾ ਵੀ ਇੱਕ ਸਪੈਸ਼ਲ ਸੈਸ਼ਨ ਹੁੰਦਾ ਹੈ ਸਪੈਸ਼ਲ ਪੀਰੀਅਡ ਹੁੰਦਾ ਹੈ ਜਿਹੜੇ ਕਿ ਬੱਚੇ ਬਹੁਤ ਹੋਣਹਾਰ ਹੁੰਦੇ ਨੇ ਉਹ ਭੰਗੜੇ ਰਾਹੀਂ ਆਪਣੀ ਪ੍ਰਤਿਭਾ ਨੂੰ ਦੂਸਰੇ ਤੱਕ ਦਿਖਾਲਣ ਦੀ ਕੋਸ਼ਿਸ਼ ਕਰਦੇ ਨੇ ਔਰ ਸਮੇਂ ਦੇ ਨਾਲ ਨਾਲ ਹਰ ਤਿਉਹਾਰਾਂ ਦਾ ਜੈਸੇ ਕਿ ਪੰਜਾਬ ਦਾ ਵਿਸਾਖੀ ਦਾ ਤਿਉਹਾਰ ਬਹੁਤ ਹੀ ਮੰਨਿਆ ਗਿਆ ਹੈ ਜਿਹਦੇ ਵਿੱਚ ਪੰਜਾਬੀ ਮੁੰਡੇ ਜਿਹੜੇ ਆ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਉਹਨਾਂ ਦੇ ਜਿਹੜੇ ਯੁ ਕੱਦ ਵੀ ਹੁੰਦੇ ਆ ਬਹੁਤ ਛੇ ਛੇ ਫੁੱਟ ਦੇ ਲੰਬੇ ਹੁੰਦੇ ਆ ਔਰ ਖੂਬ ਪੰਜਾਬੀ ਉੱਤੇ ਪੰਜਾਬੀ ਮੁੰਡੇ ਜਿਹੜੇ ਖੂਬ ਭੰਗੜਾ ਪਾਉਂਦੇ ਆ ਔਰ ਪੰਜਾਬੀਅਤ ਦਾ ਪੰਜਾਬੀਅਤ ਬਾਰੇ ਦੱਸਦੇ ਆ ਔਰ ਇਹ ਜਿਸ ਕਰਕੇ ਇਹਦੇ ਵਿੱਚ ਹਰ ਪਹਿਲੂ ਉੱਤੇ ਇਹਦੇ ਵਿੱਚ ਪੰਜਾਬ ਦੇ ਸੱਭਿਆਚਾਰਕ ਵਿੱਚ ਭੰਗੜੇ ਦੀ ਬਹੁਤ ਹੀ ਜ਼ਿਆਦਾ ਮਹੱਤਵਤਾ ਹੈ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਔਰ ਪੰਜਾਬ ਇਹਦੇ ਕਰਕੇ ਜਾਨਿਆ ਜਾਂਦਾ ਹੈ ਜਦੋਂ ਕਿ ਫਸਲਾਂ ਕੱਟਣ ਦੇ ਨਜ਼ਦੀਕ ਬੈਠੀਆਂ ਹਨ ਉਦੋਂ ਜੱਟ ਬੜੇ ਖੂਬ ਭੰਗੜਾ ਪਾਉਂਦੇ ਨੇ ਮੇਰੀਆਂ ਫਸਲਾਂ ਪੱਕ ਗਈਆਂ ਅਤੇ ਮੇਰੀਆਂ ਫਸਲਾਂ ਬਹੁਤ ਜ਼ਿਆਦਾ ਹੋ ਗਈਆਂ ਜਿਸ ਜਿਸ ਨੂੰ ਇਹ ਪ ਹਰ ਹਰ ਪਹਿਲੂਆਂ ਉੱਤੇ ਹਰ ਫੰਕਸ਼ਨ ਦੇ ਨਾਲ ਹਰ ਤਿਉਹਾਰ ਦੇ ਨਾਲ ਪੰਜਾਬ ਦੇ ਵਿੱਚ ਪ ਜਿਹੜਾ ਭੰਗੜਾ ਆ ਇਹਨੂੰ ਦੇਖਿਆ ਜਾਂਦਾ ਹੈ ਔਰ ਕੀਤਾ ਜਾਂਦਾ ਸਕੂਲਾਂ ਵਿੱਚ ਵੀ ਬੱਚਿਆਂ ਦੇ ਦੇ ਇੱਕ ਭੰਗੜੇ ਦਾ ਪੀਰੀਅਡ ਵੀ ਹੁੰਦਾ ਹੈ ਜਿਹੜੇ ਬੱਚੇ ਹੋਣਹਾਰ ਹੁੰਦੇ ਨੇ ਜਿਹਨਾਂ ਨੂੰ ਵੀ ਇਸ ਗੱਲ ਦਾ ਸ਼ੌਂਕ ਹੁੰਦਾ ਹੈ ਕਿ ਮੈਂ ਭੰਗੜਾ ਕਰਨਾ ਚਾਹੁੰਦਾ ਹਾਂ ਉਹਨਾਂ ਨੂੰ ਭੰਗੜੇ ਦੀ ਆਦਤ ਤਾਂ ਜਦੋਂ ਪੈਂਦੀ ਆ ਅਤੇ ਉਹ ਇਸ ਤੋਂ ਬਿਨਾਂ ਰਹਿ ਨਹੀਂ ਸਕਦੇ ਜਿੱਦਾ ਭੁੱਖ ਲੱਗਦੀ ਹੋਵੇ ਰੋਟੀ ਖਾਂਦੇ ਇੱਦਾਂ ਜਦੋਂ ਬੰਦਾ ਜਨੂਨ ਆਉਂਦਾ ਤਾਂ ਭੰਗੜਾ ਕਰਦਾ ਆ ਨੱਚਦਾ ਆ ਖੇਲਦਾ ਆ ਟੱਪਦਾ ਹੈ ਇਹ ਪੰਜਾਬੀਅਤ ਹਰ ਹਰ ਫੰਕਸ਼ਨ 'ਤੇ ਉੱਤੇ ਭੰਗੜੇ ਦਾ ਪ੍ਰੋਗਰਾਮ ਹੁੰਦਾ ਹੈ ਜਿੱਦਾਂ ਛੱਬੀ ਜਨਵਰੀ ਲਾ ਲਓ ਪੰਦਰਾਂ ਅਗਸਤ ਲਾ ਲਓ ਸਕੂਲਾਂ ਦੇ ਬੱਚੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪਾਰਟੀਸਪੇਟ ਕਰਦੇ ਨੇ ਔਰ ਇਸ ਲਈ ਪੰਜਾਬ ਦੇ ਤਿਉਹਾਰਾਂ ਵਿੱਚ ਭੰਗੜੇ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ